ਪੰਜਾਬੀ ਬਾਸ਼ ਭਾਸ਼ਾ ਆਸ ਪਾਸ ਦੇ ਮਾਹੌਲ ਕਰਕੇ ਬਹੁਤ ਪ੍ਰਭਾਵਿਤ ਹੋਈ ਹੈ ਕਿਉਂਕਿ ਪੰਜਾਬ ਵਿੱਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ ਇਹਨਾਂ ਦੀਆਂ ਅਲੱਗ ਅਲੱਗ ਭਾਸ਼ਾਵਾਂ ਹਨ ਸੰਸਕ੍ਰਿਤ ਬਹੁਤ ਪੁਰਾਣੀ ਭਾਸ਼ਾ ਹੈ ਪੰਜਾਬੀ ਭਾਸ਼ਾ ਦੇ ਸ਼ਬਦ ਬਹੁਤ ਸਾਰੇ ਅੱਖਰ ਇਸੇ ਵਿੱਚੋਂ ਹੀ ਨਿਕਲੇ ਹਨ ਅੰਗਰੇਜ਼ੀ ਦੇ ਬਹੁਤੇ ਪ ਸ਼ਬਦ ਬੋਲਣ ਵਿੱਚ ਪੰਜਾਬੀ ਭਾਸ਼ਾ ਵਰਗੇ ਲੱਗਦੇ ਹਨ ਪਰ ਮਤਲਬ ਇਹਨਾਂ ਦੇ ਅਲੱਗ ਅਲੱਗ ਹੁੰਦੇ ਹਨ